ਵੈਸੇ ਤਾਂ ਭਾਰਤ ਵਿੱਚ ਬਹੁਤ ਸਾਰੇ ਜਗ੍ਹਾ ਹਨ ਜਿੱਥੇ ਆਪਾਂ ਘੁੰਮ ਸਕਦੇ ਹਾਂ ਪਰ ਮੈਂ ਪੰਜਾਬ ਦੀ ਵਸਨੀਕ ਹਾਂ ਇਸ ਕਰਕੇ ਮੈਨੂੰ ਪੰਜਾਬ ਦੇ ਖੇਤਰਾਂ ਦੇ ਵਿੱਚ ਹੀ ਘੁੰਮਣਾ ਬਹੁਤ ਵਧੀਆ ਲੱਗਦਾ ਆ ਅਤੇ ਮੈਂ ਅਗਰ ਗੱਲ ਕਰਾਂ ਤਾਂ ਇਹ ਮੇਰੀ ਮਨਪਸੰਦ ਜਗ੍ਹਾ ਦੀ ਤਾਂ ਉਹ ਚੰਡੀਗੜ੍ਹ ਆ ਚੰਡੀਗੜ੍ਹ ਝੀਲ ਜਿੱਥੇ ਮੈਂ ਜਾਣਾ ਬਹੁਤ ਜ਼ਿਆਦਾ ਪਸੰਦ ਕਰਦੀ ਹਾਂ ਜਦੋਂ ਵੀ ਮੈਂ ਸਟਰੈੱਸ ਦੇ ਵਿੱਚ ਹੁੰਦੀ ਹਾਂ ਜਾਂ ਮੇਰੇ ਕੋਲ ਬਹੁਤ ਜ਼ਿਆਦਾ ਕੰਮ ਦਾ ਬੋਝ ਹੁੰਦਾ ਆ ਤਾਂ ਮੈਂ ਚਾਹੁੰਦੀ ਹਾਂ ਕਿ ਮੈਂ ਉਸ ਸਟਰੈੱਸ ਨੂੰ ਰਿਲੀਫ਼ ਕਰ ਦੇਵਾਂ ਤਾਂ ਉਸ ਕਰਕੇ ਮੈਂ ਫਿਰ ਸੁਖਨਾ ਲੇਕ 'ਤੇ ਜਾਂਦੀ ਹਾਂ ਅਤੇ ਉੱਥੋਂ ਦਾ ਪੂਰਾ ਨਜ਼ਾਰਾ ਦੇਖ ਕੇ ਮੈਂ ਬਿਲਕੁਲ ਸ਼ਾਂਤ ਹੋ ਜਾਂਦੀ ਹਾਂ ਅਤੇ ਮਨ ਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਆ ਉੱਥੋਂ ਦੀਆਂ ਵਾਦੀਆਂ ਮਤਲਬ ਪਹਾੜ ਝੀਲ ਦਾ ਪਾਣੀ ਇੱਦਾਂ ਲੱਗਦਾ ਜਿਵੇਂ ਮੇਰੇ ਨਾਲ਼ ਗੱਲਾਂ ਕਰਦੇ ਹੋਣ ਤਾਂ ਉੱਥੇ ਜਾ ਕੇ ਮੈਨੂੰ ਬਹੁਤ ਵਧੀਆ ਲੱਗਦਾ ਆ